ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਦਰਸ਼ਨ ਸਿੰਘ ਝੁੰਬੇ ਤੋਂ ਬੋਲ ਰਿਹਾ ਹਾਂ ਮੈਂ ਆਪ ਜੀ ਨੂੰ ਇੱਕ ਸੁਝਾਓ ਦੇਣਾ ਚਾਹੁੰਦਾ ਹਾਂ ਕਿ ਮੈਂ ਆਪ ਜੀ ਦੀ ਗੱਡੀ ਕਿਰਾਏ 'ਤੇ ਲੈ ਕੇ ਜਾਂਦਾ ਹੁੰਦਾ ਸੀ ਪਰ ਇੱਕ ਦਿਨ ਜਦੋਂ ਮੈਂ ਗੱਡੀ ਬੁੱਕ ਕਰਵਾਈ ਤਾਂ ਉਨ੍ਹਾਂ ਨੇ ਮੈਨੂੰ ਡਰਾਈਵਰ ਦਿੱਤਾ ਜਿਸ ਦਾ ਕੋਈ ਵੀ ਕਰੋਨਾ ਦੇ ਪੱਖ ਵਿੱਚ ਸੁਝਾਅ ਨਹੀਂ ਸੀ ਨਾ ਤਾਂ ਉਸਨੇ ਮਾਸਕ ਪਾਇਆ ਹੋਇਆ ਸੀ ਔਰ ਨਾ ਹੀ ਗੱਡੀ ਦੀ ਇੰਨੀ ਜ਼ਿਆਦਾ ਸਫ਼ਾਈ ਸੀ ਜਿਸ ਕਰਕੇ ਉਸਨੂੰ ਖੰਘ ਵਗੈਰਾ ਦੀ ਸ਼ਿਕਾਇਤ ਵੀ ਸੀ ਅਤੇ ਮੈਂ ਇਸ ਕਰਕੇ ਤੁਹਾਨੂੰ ਕਹਿੰਦਾ ਹਾਂ ਕਿ ਇਹੋ ਜਿਹੇ ਟੈਮ ਦੇ ਉੱਤੇ ਗੱਡੀ ਦੀ ਸਫ਼ਾਈ ਹੋਰ ਕਰੋਨਾ ਦੇ ਵਾਸਤੇ ਆਪਾਂ ਮਾਸਕ ਵਗੈਰਾ ਸਾਰਾ ਕੁਛ ਪਾ ਕੇ ਆਉਣ ਦੀ ਕ੍ਰਿਪਾਲਤਾ ਕਰੇ ਅੱਗੇ ਤੋਂ ਜੇਕਰ ਉਸ ਤਰ੍ਹਾਂ ਹੀ ਆਏ ਤਾਂ ਮੈਂ ਤੁਹਾਡੀ ਗੱਡੀ ਬੁੱਕ ਨਹੀਂ ਕਰੂੰਗਾ ਕਿਰਪਾ ਕਰਕੇ ਆਪ ਉਸ ਉਸ ਡਰੈਵਰ ਨੂੰ ਅਗਾਹ ਕਰ ਦੇਣਾ ਕਿ ਅੱਗੇ ਵਾਸਤੇ ਉਹ ਆਪਣਾ

ਪਹਿਰਾਵਾ ਔਰ ਠੀਕ ਸਫ਼ਾਈ ਰੱਖ ਕੇ ਗੱਡੀ 'ਤੇ ਡਰਾਈਵਿੰਗ ਕਰਨਾ ਨਿਸ਼ਚਿਤ ਸਮਝੇ ਇਸ ਕਰਕੇ